ਸਤਿ ਸ਼੍ਰੀ ਅਕਾਲ ਭਾਅ ਜੀ ਪ੍ਰੀਆ ਟਰੈਵਲ ਏਜੰਸੀ ਤੋਂ ਬੋਲ ਰਹੇ ਹੋ ਭਾਅ ਜੀ ਮੈਂ ਤੁਹਾਨੂੰ ਇੱਕ ਡਰਾਈਵਰ ਭਾਅ ਜੀ ਦੀ ਫੀਡਬੈਕ ਦੇਣੀ ਸੀਗੀ ਉਸ ਮੇਰੇ ਨਾਲ ਗਏ ਸੀਗੇ ਦਿੱਲੀ ਤੱਕ ਮੈਂ ਆਪਣੇ ਭਾਅ ਜੀ ਨੂੰ ਪਿਕ ਕਰਨ ਜਾਣਾ ਸੀਗਾ ਅਤੇ ਉਹਨਾਂ ਦੀ ਪੂਰੀ ਫੈਮਲੀ ਆ ਰਹੀ ਸੀ ਉਹਨਾਂ ਦੇ ਨਾਲ ਤਾਂ ਮੈਂ ਤੁਹਾਡੀ ਏਜੰਸੀ ਨੂੰ ਕੋਂਟੈਕਟ ਕੀਤਾ ਸੀਗਾ ਅਤੇ ਉਹ ਭਾਅ ਜੀ ਨੂੰ ਤੁਸੀਂ ਭੇਜਿਆ ਸੀਗਾ ਤਾਂ ਅਸੀਂ ਉਹਨਾਂ ਦੇ ਨਾਲ ਬਹੁਤ ਵਧੀਆ ਟਾਈਮ ਇੰਨਜੋਏ ਕੀਤਾ ਕਿਉਂਕਿ ਇੱਕ ਤਾਂ ਉਹਨਾਂ ਦੀ ਗੱਡੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਸੀਗੀ ਅਤੇ ਜਿੱਦਾਂ ਕਿ ਕੋਵਿਡ ਦਾ ਟਾਈਮ ਚੱਲ ਰਿਹਾ ਤਾਂ ਉਹਨਾਂ ਨੇ ਸੈਨਟਾਈਜ਼ਰ ਵਗੈਰਾ ਵੀ ਸਾਰਾ ਕੁਛ ਆਪਣੀ ਗੱਡੀ ਵਿੱਚ ਰੱਖਿਆ ਹੋਇਆ ਸੀ ਅਤੇ ਉਹ ਬਹੁਤ ਹੀ ਵਧੀਆ ਢੰਗ ਦੇ ਨਾਲ ਗੱਡੀ ਚਲਾ ਵੀ ਰਹੇ ਸੀ ਅਤੇ ਰਾਹ ਵਿੱਚ ਜਿੱਥੇ ਵੀ ਅਸੀਂ ਉਹਨਾਂ ਨੂੰ ਕਿਤੇ ਰੁਕਣ ਦੇ ਲਈ ਕਿਹਾ ਉਹਨਾਂ ਨੇ ਸਾਡੀ ਗੱਲ ਮੰਨ ਕੇ ਉਸੇ ਹੀ ਜਗ੍ਹਾ 'ਤੇ ਸਾਨੂੰ ਰੁਕਵਾ ਕੇ ਜੋ ਵੀ ਅਸੀਂ ਖਾਣਾ ਵਗੈਰਾ ਖਾਣਾ ਸੀਗਾ ਉਹਦੇ ਵਿੱਚ ਸਾਡੀ ਬਹੁਤ ਹੈਲਪ ਕੀਤੀ ਜਿੱਦਾਂ ਮੈਂ ਪਹਿਲੀ ਵਾਰ ਦਿੱਲੀ ਜਾ ਰਹੀ ਸੀ ਤਾਂ ਮੈਂ ਉਹਨਾਂ ਨੂੰ ਜੋ ਜੋ ਵੀ ਦੱਸਿਆ ਸੀ ਆਪਣੀਆਂ ਕੰਡੀਸ਼ਨਸ ਉਹਦੇ ਅਕੋਡਿੰਗਲੀ ਹੀ ਉਹਨਾਂ ਨੇ ਸਾਰਾ ਸਾਡਾ ਸਾਥ ਦਿੱਤਾ ਅਤੇ ਜਦੋਂ ਅਸੀਂ ਦਿੱਲੀ ਏਅਰਪੋਰਟ 'ਤੇ ਪਹੁੰਚੇ ਤਾਂ ਮੇਰੇ ਭਾਅ ਜੀ ਦੀ ਫਲਾਈਟ ਲੇਟ ਸੀਗੀ ਤਾਂ ਉਹਦੇ ਉਹਦੇ ਕਰਕੇ ਡਰਾਈਵਰ ਭਾਅ ਜੀ ਨੂੰ ਵੀ ਬਹੁਤ ਟਾਈਮ ਵੇਟ ਕਰਨੀ ਪਈ ਅਤੇ ਜਦੋਂ ਅਸੀਂ ਆਏ ਹਾਂ ਆਉਂਦੇ ਹੋਏ ਵੀ ਮੇਰੇ ਭਾਅ ਜੀ ਵੀ ਬਹੁਤ ਖੁਸ਼ ਸੀਗੇ ਡਰਾਈਵਰ ਭਾਅ ਜੀ ਦੇ ਬਿਹੇਵੀਅਰ ਦੇ ਨਾਲ ਵੀ ਅਤੇ ਜਿਸ ਅਸਾ ਢੰਗ ਦੇ ਨਾਲ ਉਹ ਗੱਡੀ ਚਲਾ ਰਹੇ ਸੀ ਉਹਦੇ ਨਾਲ ਵੀ ਅਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗੀ ਕਿ ਮੈਂ ਉਨ ਉਸ ਡਰਾਈਵਰ ਭਾਅ ਜੀ ਦੀ ਡਰਾਈਵਿੰਗ ਸਕਿੱਲਸ ਤੋਂ ਬਹੁਤ ਜ਼ਿਆਦਾ ਹੀ ਪ੍ਰਭਾਵਿਤ ਹਾਂ ਅਤੇ ਮੈਂ ਚਾਹੁੰਦੀ ਹਾਂ ਕਿ ਜਦੋਂ ਕਦੇ ਵੀ ਅੱਗੇ ਮੈਨੂੰ ਲੋੜ ਪਏ ਤਾਂ ਤੁਸੀਂ ਇਹ ਵਾਲੇ ਭਾਅ ਜੀ ਨੂੰ ਹੀ ਭੇਜਿਓ ਸਾਡੇ ਲਈ ਅਤੇ ਜਾਂ ਹੋ ਸਕੇ ਤਾਂ ਮੈਨੂੰ ਤੁਸੀਂ ਉਹਨਾਂ ਦਾ ਨੰਬਰ ਦੇ ਦਿਉ ਕਿਉਂਕਿ ਮੈਂ ਅੱਗੇ ਤੋਂ ਵੀ ਉਹਨਾਂ ਨੂੰ ਹੀ ਜਿੱਥੇ ਵੀ ਜਾਣਾ ਹੋਵੇ ਨਾਲ ਲੈ ਕੇ ਜਾਣਾ ਚਾਹੁੰਦੀ ਹਾਂ ਥੈਂਕ ਯੂ ਭਾਅ ਜੀ